ਜਿਵੇਂ ਕਿ ਤੁਹਾਨੂੰ ਅੱਜ ਦੇ ਸਮਾਜ ਬਾਰੇ ਪਤਾ ਹੀ ਹੈ ਕਿ ਲੋਕ ਆਪਣੇ ਸੱਭਿਆਚਾਰ ਅਤੇ ਪ੍ਰੰਪਰਾਵਾਂ ਨੂੰ ਛੱਡ ਕੇ ਦੂਜਿਆਂ ਦੇ ਸੱਭਿਆਚਾਰ ਅਤੇ ਪ੍ਰੰਪਰਾਵਾਂ ਨੂੰ ਜ਼ਿਆਦਾ ਅਪਣਾ ਰਹੇ ਹਨ ਮਤਲਬ ਕਿ ਉਹ ਜਿਹੜੇ ਵਿਦੇਸ਼ੀ ਸੱਭਿਆਚਾਰ ਵਾਲੇ ਪ੍ਰੰਪਰਾਵਾਂ ਹਨ ਉਹਨਾਂ ਨੂੰ ਜ਼ਿਆਦਾ ਫੋਲੋ ਕਰ ਰਹੇ ਅਤੇ ਇਸ ਤਰ੍ਹਾਂ ਉਹ ਆਪਣੇ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਨ ਜੇਕਰ ਅਸੀਂ ਆਪਣੇ ਸੱਭਿਆਚਾਰ ਦੀ ਗੱਲ ਕਰੀਏ ਤਾਂ ਸਾਡੇ ਸੱਭਿਆਚਾਰ ਦਾ ਪਹਿਰਾਵਾ ਬਹੁਤ ਹੀ ਸਾਦਾ ਅਤੇ ਬਹੁਤ ਹੀ ਸੁੰਦਰ ਹੈ ਅਸੀਂ ਸਾਡੇ ਸੱਭਿਆਚਾਰ ਦੇ ਪ੍ਰੰਪਰਾਵਾਂ ਦੇ ਵਿੱਚ ਲੋਕ ਸੰਗੀਤ ਘੋੜੀਆਂ ਆਦਿ ਇਹ ਸਾਰਾ ਕੁਝ ਮਤਲਬ ਕਿ ਇਸ ਦੇ ਵਿੱਚ ਆਉਂਦਾ ਹੈਗਾ ਹੈ ਆ ਜੇ ਅਸੀਂ ਆਪਣੇ ਪਹਿਰਾਵੇ ਕੱਪੜੇ ਅਤੇ ਗਹਿਣਿਆਂ ਬਾਰੇ ਗੱਲ ਕਰੀਏ ਤਾਂ ਸਾਡੇ ਜਿਹੜੇ ਪੰਜਾਬੀ ਸੱਭਿਆਚਾਰ ਦਾ ਪਹਿਰਾਵਾ ਗਹਿਣੇ ਕੱਪੜੇ ਇਹ ਬਹੁਤ ਹੀ ਵਧੀਆ ਹਨ ਜੇ ਅਸੀਂ ਇਹਨਾਂ ਨੂੰ ਦੂਸਰਿਆਂ ਨਾਲ ਕੰਪੇਅਰ ਕਰੀਏ ਉੱਦਾਂ ਤਾਂ ਸਾਰੇ ਦੇਸ਼ ਦੇ ਵਿੱਚ ਸਾਰੀਆਂ ਦੇ ਆਪਣੇ ਆਪਣੇ ਪਹਿਰਾਵੇ ਅਤੇ ਆਪਣੇ ਆਪਣੇ ਸੱਭਿਆਚਾਰ ਹਨ ਅਸੀਂ ਆਪਣੇ ਪੰਜਾਬ ਦੇ ਸੱਭਿਆਚਾਰ ਨੂੰ ਨਾ ਭੁੱਲ ਕੇ ਅਸੀਂ ਇਸ ਨੂੰ ਅੱਗੇ ਲੈ ਕੇ ਜਾਵਾਂਗੇ ਤਾ ਤਾਂ ਹੀ ਸਾਡਾ ਜਿਹੜਾ ਸੱਭਿਆਚਾਰ ਹੈ ਆ ਉਹ ਜਿੰਦਾ ਰਹੇਗਾ ਨਹੀਂ ਤਾਂ ਅਸੀਂ ਆਪਣੇ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਨ ਜੇ ਅਸੀਂ ਆਪਣੇ ਸੱਭਿਆਚਾਰ ਦੇ ਪਹਿਰਾਵੇ ਦੀ ਗੱਲ ਕਰੀਏ ਤਾਂ ਸਾਡੇ ਸੱਭਿਆਚਾਰ ਦੇ ਪਹਿਰਾਵੇ ਦੇ ਵਿੱਚ ਮੁੰਡਿਆਂ ਦੇ ਲਈ ਕੁੜਤੇ ਪਜਾਮੇ ਅਤੇ ਔਰਤਾਂ ਦੇ ਲਈ ਸੂਟ ਆਉਂਦੇ ਹਨ ਅਤੇ ਜੇ ਗਹਿਣਿਆਂ ਦੀ ਗੱਲ ਕਰੀਏ ਤਾਂ ਮੁੰਡਿਆਂ ਦੇ ਲਈ ਕੈਂਠੇ ਕੜੇ ਅਤੇ ਕਪ ਔਰਤਾਂ ਦੇ ਲਈ ਗਲੇ ਦੇ ਹਾਰ ਕੰਨਾਂ ਦੇ ਝੁਮਕੇ ਮੱਥੇ ਦਾ ਟਿੱਕਾ ਝਾਜਰਾਂ ਵੰਗਾਂ ਆਦਿ ਇਹ ਸਾਰਾ ਕੁਛ ਆਉਂਦਾ ਹੈਗਾ ਹੈ ਆ